ਸਕੂਲਾਂ ਦੇ ਵਿੱਚ ਕਾਫ਼ੀ ਵਿਸ਼ੇ ਪੜ੍ਹਾਏ ਜਾਂਦੇ ਹਨ ਜਿੰਨੇ ਵੀ ਅਧਿਆਪਕ ਹੈ ਸਾਰੇ ਪੜੇ ਲਿਖੇ ਹਨ ਸਕੂਲਾਂ 'ਚ ਅੰਗਰੇਜ਼ੀ ਪੰਜਾਬੀ ਹਿੰਦੀ ਹਿਸਟਰੀ ਸਮਾਜਿਕ ਆਰਟ ਐਂਡ ਕਰਾਫਟ ਜੀ ਕੇ ਹਰ ਇੱਕ ਬਾਰੇ ਪਰੋਪਰ ਨੋਲੇਜ਼ ਦਿੱਤੀ ਜਾਂਦੀ ਹੈ ਅੱਜ ਕੱਲ੍ਹ ਬੱਚਿਆਂ ਨੂੰ ਅਗਰ ਤੁਸੀਂ ਵੱਡੇ ਹੋ ਕੇ ਡੋਕਟਰ ਬਣਾਉਣਾ ਹੈਗਾ ਜਾਂ ਤੁਸੀਂ ਆਈ ਐਸ ਔਫਿਸਰ ਬਣਾਉਣਾ ਹੈ ਉਹਦੇ ਵਾਸਤੇ ਓਲੰਪੀਆਡ ਦੇ ਪੇਪਰ ਹੁੰਦੇ ਹੈ ਜਿਹਨੂੰ ਐਸ ਓ ਐਸ ਵੀ ਕਹਿੰਦੇ ਹੈਗੇ ਨੇ ਇਹਦੇ ਇਲਾਵਾ ਜਦ ਤੁਸੀਂ ਦੇਖਿਆ ਹੋਏਗਾ ਕਈ ਬੱਚਿਆਂ 'ਚ ਮੈਂਥ ਦਾ ਫੋਬੀਆ ਹੁੰਦਾ ਹੈ ਉਹਨਾ ਨੂੰ ਲੱਗਦਾ ਹੈ ਮੈਥ ਸਾਡੇ ਤੋਂ ਹੋਏਗਾ ਨਹੀਂ ਉਹਦੇ ਵਾਸਤੇ ਜਿਹੜਾ ਐਬਾਕਸ ਆ ਗਿਆ ਵੈਦਿਕ ਮੈਥ ਆ ਗਿਆ ਇਹ ਚੀਜ਼ਾਂ ਸਭ ਕੁਝ ਅਧਿਆਪਕਾਂ ਵੱਲੋਂ ਕਰਾਏ ਜਾ ਰਹੇ ਨੇ ਕਿਉਂਕਿ ਜਿਹੜੇ ਅੱਜ ਕੱਲ੍ਹ ਦੇ ਅਧਿਆਪਕ ਹੈ ਉਹਨਾਂ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਉਹਨਾਂ ਦੀ ਕੋਆਲੀਫਿਕੇਸ਼ਨ ਬਹੁਤ ਜ਼ਿਆਦਾ ਹਾਈ ਹੋਵੇ ਜਿਵੇਂ ਕਿ ਬੀ ਐੱਡ ਦੇ ਨਾਲ ਦੇ ਨਾਲ ਉਹਨਾਂ ਦਾ ਟੈੱਟ ਦਾ ਇਗਜ਼ਾਮ ਕਲੀਅਰ ਵੀ ਹੋਣਾ ਜ਼ਰੂਰੀ ਹੈ ਬੱਚੇ ਬਹੁਤ ਕੁਝ ਸਿੱਖਦੇ ਹਨ ਅਸੀਂ ਸਿਰਫ਼ ਪੜ੍ਹਾਈ ਦੀ ਗੱਲ ਹੀ ਨਹੀਂ ਕਰਦੇ ਇੱਕ ਹਸਤਸ਼ੇਪ ਦੀ ਵੀ ਗੱਲ ਕਰਦੇ ਹਾਂ ਕਿ ਬੱਚੇ ਜਿਹੜਾ ਹੈਗਾ ਹੱਥੀਂ ਕੰਮ ਬਹੁਤ ਜ਼ਿਆਦਾ ਸਿੱਖ ਰਹੇ ਹੈ ਜਿਵੇਂ ਅਸੀਂ ਕਹਿੰਦੇ ਹੈ ਬੈਸਟ ਆਉਟ ਆਫ਼ ਦੀ ਵੇਸਟ ਕਿ ਇੱਕ ਪੁਰਾਣੀ ਚੀਜ਼ ਨੂੰ ਨਵੀਂ ਚੀਜ਼ ਵਿੱਚ ਕਿਵੇਂ ਬਦਲਾਵ ਕਰਨਾ ਹੈਗਾ ਉਹ ਪੁਰਾਣੀ ਚੀਜ਼ਾਂ ਨੂੰ ਜਿਵੇਂ ਕਿ ਤੁਹਾਨੂੰ ਮੈਂ ਇਗਸ ਦੱਸਦੀ ਹਾਂ ਕਿ ਇੱਕ ਬੋਤਲ ਹੈ ਅਸੀਂ ਇੱਕ ਬਾਹਰੋਂ ਪੋਟ ਖਰੀਦਣ ਨਾਲੋਂ ਇੱਕ ਪਲਾਸਟਿਕ ਦੀ ਬੋਤਲ ਨੂੰ ਕਿਵੇਂ ਇੱਕ ਪੋਟ ਦੇ ਵਿੱਚ ਤਬਦੀਲ ਕਰ ਸਕਦੇ ਹਨ ਕਿਵੇਂ ਉਹਦੀ ਅਗਰ ਅਸੀਂ ਕਟਿੰਗ ਕਰਦੇ ਹਾਂ ਕਿਵੇਂ ਉਹਦੀ ਜਿਹੜੀ ਸ਼ੇਪ ਹੈਗੀ ਉਹ ਕਿਵੇਂ ਚੇਂਜ ਕੀਤੀ ਜਾ ਸਕਦੀ ਹੈ ਪੁਰਾਣੀ ਚੂੜੀਆਂ ਦੇ ਨਾਲ ਤੁਸੀਂ ਦੇਖੁਗੇ ਕਿ ਕਈ ਸਕੂਲਾਂ ਦੇ ਵਿੱਚ ਇੱਕ ਮੂਰਤੀਆਂ ਬਣਾਈਆਂ ਗਈਆਂ ਕਿ ਚੂੜੀਆਂ ਤੋੜ ਕੇ ਇੱਕ ਕਲੇਅ ਮੌਡਲਿੰਗ ਦੇ ਥਰੂ ਚੂੜੀਆਂ ਲਗਾ ਕੇ ਉਹਦੀ ਬਹੁਤ ਜ਼ਿਆਦਾ ਦਿੱਤੀ ਗਈ ਹੈ ਸਰਕਾਰੀ ਸਕੂਲਾਂ 'ਚ ਤੁਹਾਨੂੰ ਦੇਖਣ ਨੂੰ ਮਿਲੇਗਾ ਪਹਿਲੇ ਜਿਹੜੇ ਸਰਕਲ ਤ੍ਰਿਕੋਣ ਸਾਨੂੰ ਸਮਝਾਏ ਜਾਂਦੇ ਸੀ ਅੱਜ ਕੱਲ੍ਹ ਉਹਨਾਂ ਨੂੰ ਇੱਕ ਮੂਰਤੀ ਦੇ ਤੌਰ 'ਤੇ ਬਣਾ ਕੇ ਬੱਚਿਆਂ ਨੂੰ ਸਿਖਾਈਆਂ ਜਾਂਦਾ ਹੈ ਕਿਉਂਕਿ ਜੋ ਬੱਚਾ ਚੀਜ਼ ਦੇਖਦਾ ਉਹ ਜਲਦੀ ਸਿੱਖਦਾ ਇੰਝ ਹੀ ਤੁਸੀਂ ਟਾਇਰਾਂ ਦੇ ਦੇਖੇ ਹੋਣਗੇ ਸਕੂਲਾਂ ਵਿੱਚ ਟਾਇਰਾਂ ਦੇ ਨਾਲ ਸੋਫ਼ੇ ਬਣਾਏ ਜਾ ਰਹੇ ਨੇ ਕੁਰਸੀਆਂ ਬਣਾਈਆਂ ਜਾ ਰਹੀਆਂ ਵਰਕਿੰਗ ਮੌਡਲਜ਼ ਬਣਦੇ ਹੈਗੇ ਨੇ ਵਰਕਿੰਗ ਮੌਡਲ 'ਚ ਜਿਵੇਂ ਇੱਕ ਰੋਬਟ ਬਣਾਇਆ ਗਿਆ ਰੋਬਟ ਦੇ ਵਿੱਚ ਬੱਚਾ ਉਹਦੇ ਵਿੱਚ ਟੈੱਕਨੀਕ ਫਿੱਟ ਕਰਕੇ ਉਹ ਚਲਦਾ ਫਿਰਦਾ ਰੋਬਟ ਬਣੇਗਾ ਬੱਚਿਆਂ ਦਾ ਦਿਮਾਗ ਬਹੁਤ ਜ਼ਿਆਦਾ ਵਿਕਸਿਤ ਹੋ ਚੁੱਕਾ ਹੈਗਾ ਹੈ ਕਿ ਉਹ ਇੱਕ ਛੋਟੀ ਜਿਹੀ ਚੀਜ਼ 'ਚ ਨੂੰ ਵੀ ਦੇਖ ਕੇ ਉਹਦੇ ਵਿੱਚ ਕਾਫ਼ੀ ਬਦਲਾਵ ਕਰ ਦਿੰਦੇ ਹਨ